ਜਿੰਨਾਂ ਕੋਲ ਬਕਾਇਦਾ ਲ਼ ਲਾਈਸੈਂਸ ਹਨ ਅਤੇ ਉਹ ਤੁਹਾਡਾ ਫਾਈਨਾਂਸ ਕਰਕੇ ਤੁਹਾਨੂੰ ਪੈਸਾ ਜਾਂ ਕਰਜ਼ਾ ਦੇ ਸਕਦੇ ਹਨ ਉਸ ਤੋਂ ਤੁਸੀਂ ਬਾਅਦ ਵਿੱਚ ਕਿਸ਼ਤਾਂ ਰਾਹੀਂ ਪੈਸੇ ਦੇ ਸਕਦੇ ਹੋ ਜੇਕਰ ਵਿਅਕਤੀਗਤ ਪੈਸੇ ਦੇਣ ਦੇ ਉਧਾਰ ਬਾਰੇ ਦੇਖਿਆ ਜਾਵੇ ਤਾਂ ਪਿੰਡਾਂ ਦੇ ਵਿੱਚ ਜਿੱਦਾਂ ਕਿ ਕ ਆੜਤੀਏ ਹੁੰਦੇ ਹਨ ਕਮਿਸ਼ਨ ਏਜੈਂਟ ਹੁੰਦੇ ਹਨ ਇਹ ਇਹ ਇਹਨਾਂ ਕੋਲ ਫਸਲ ਛੇ ਮਹੀਨੇ ਬਾਅਦ ਪਹੁੰਚਦੀ ਹੈ ਜਦ ਕਿਸੇ ਖੇਤੀਬਾੜੀ ਜਾਂ ਕਿਸਾਨ ਨੂੰ ਕਿਸੇ ਪੈਸੇ ਦੀ ਜ਼ਰੂਰਤ ਹੁੰਦੀ ਹੈ ਉਹਨਾਂ ਤੋਂ ਕਰਜ਼ਾ ਲੈ ਲੈਂਦਾ ਹੈ ਅਤੇ ਉਸਨੂੰ ਜਦੋਂ ਉਸਦੀ ਛੇ ਮਹੀਨੇ ਬਾਅਦ ਫਸਲ ਆ ਜਾਂਦੀ ਹੈ ਤਾਂ ਉਸਦੇ ਫਸਲ ਉਸ ਨੂੰ ਵੇਚ ਕੇ ਆਪਣਾ ਕਰਜ਼ਾ ਉਸ ਤੋਂ ਲਾਹ ਦਿੰਦਾ ਹੈ ਇਸ ਤੋਂ ਇਲਾਵਾ ਹੋਰ ਵੀ ਛੋਟੀਆਂ ਛੋਟੀਆਂ ਕੋਈ ਦੁਕਾਨਾਂ ਜਾਂ ਕੁਝ ਆਂਡੀਨਾ ਤੋਂ ਆਪਾਂ ਕਰਜ਼ਾ ਲੈ ਸਕਦੇ ਹਾਂ